ਹਾਂਜੀ ਸਾਨੂੰ ਜਾਨਵਰਾਂ ਦੀ ਖਾਦ ਤੋਂ ਬਹੁਤ ਲਾਭ ਮਿਲਦੇ ਹਨ ਅਸੀਂ ਇਹਨਾਂ ਦੀ ਜਾਨਵਰਾਂ ਦੀ ਖਾਦ ਤੋਂ ਬਹੁਤ ਸਾਰੇ ਪੋਸ਼ਟਿਕ ਤੱਤਾਂ ਦਾ ਪ੍ਰਬੰਧ ਕਰਦੇ ਹਾਂ ਇਹ ਸਾਡੇ ਜਿਵੇਂ ਖੇਤਾਂ ਵਿੱਚ ਪਾਇਆ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਇਹਨਾਂ ਨੂੰ ਸਾਡੇ ਜਿਹੜੇ ਖੇਤ ਆ ਇਹਨਾਂ ਦੀ ਖਾਦ ਤੋਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈਗਾ ਫਿਰ ਇਹਦੀ ਸ ਜਿਹੜੀ ਖਾਦ ਹੁੰਦੀ ਆ ਉਹ ਸਾਡੀਆਂ ਸਬਜ਼ੀਆਂ ਵਿੱਚ ਵੀ ਪਾਈ ਜਾਂਦੀ ਹੈ ਜਿਵੇਂ ਕਿ ਆਪਣੇ ਖੇਤ 'ਚ ਰੇਹ ਨੂੰ ਕਹਿੰਦੇ ਰੇਹ ਸਪਰੇ ਦਾ ਅਸੀਂ ਘੱਟ ਯੂਜ ਕਰਦੇ ਹਾਂ ਜਾਨਵਰਾਂ ਦੀ ਖਾਦ ਦਾ ਅਸੀਂ ਜ਼ਿਆਦਾ ਯੂਜ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਵਧੀਆ ਪੋਸ਼ਟਿਕ ਤੱਤ ਹੁੰਦੇ ਹਨ ਤੋ ਕਿ ਇਹਨਾਂ 'ਚੋਂ ਫਿਰ ਇਸ ਨੂੰ ਅਸੀਂ ਸਾਰੇ ਖੇਤਾਂ ਵਿੱਚ ਯੂਜ ਕਰਦੇ ਹਾਂ ਔਰ ਘਰ ਦੀਆਂ ਜਿਹੜੀਆਂ ਸਬਜ਼ੀਆਂ ਬਣਾਉਂਦੇ ਹਨ ਸਾਫ਼ ਇਹਨਾਂ ਨੂੰ ਸਾਂਭ ਸੰਭਾਲ ਜਾਨਵਰਾਂ ਦੀ ਸਾਂਭ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਫਿਰ ਅਸੀਂ ਜਦੋਂ ਵੀ ਅਸੀਂ ਜਾਨਵਰਾਂ ਨੂੰ ਸੰਭਾਲਦੇ ਹਾਂ ਕਿ ਉਹਨਾਂ ਦੀ ਖਾਦ ਨੂੰ ਅਸੀਂ ਇੱਕ ਜਗ੍ਹਾ 'ਤੇ ਜਮ੍ਹਾਂ ਕਰ ਲੈਂਦੇ ਹਾਂ ਫਿਰ ਉਹ ਨੂੰ ਜਾਨਵਰਾਂ ਨੂੰ ਖੁਰਾਕ ਬਹੁਤ ਚੰਗੀ ਖੁਰਾਕ ਵੀ ਪਾਉਂਦੇ ਹਾਂ ਫਿਰ ਉਹਨਾਂ ਦੇ ਉਹ 'ਚ ਉਹਨਾਂ ਨੂੰ ਜਾਨਵਰਾਂ ਨੂੰ ਅਸੀਂ ਖੁਰਾਕ ਚੰਗੀ ਪਾਵਾਂਗੇ ਤਾਂ ਸਾਨੂੰ ਇੱਕ ਚੰਗੀ ਚੰਗੀ ਪੌਸ਼ਟਿਕ ਤੱਤ ਮਿਲਣਗੇ ਕਿਉਂਕਿ ਉਹ ਹੀ ਆਪਾਂ ਖਾਦ ਆਪਣੇ ਸ ਸਬਜ਼ੀਆਂ ਨੂੰ ਜਿਵੇਂ ਗੇਹੂੰ ਨੂੰ ਪਾ ਦਿੱਤੀ ਸਬਜਜ਼ੀਆਂ ਨੂੰ ਪਾ ਦਿੱਤੀ ਪਾਲਕ ਮੇਥੇ ਅਸੀਂ ਉਹਨਾਂ ਨੂੰ ਘਰ ਵਿੱਚ ਯੂਜ ਕਰਦੇ ਹਾਂ ਫਿਰ ਜਿੱਦਾਂ ਵੀ ਸਾਨੂੰ ਸਰਦੀਆਂ ਜਿਵੇਂ ਸਰਦੀਆਂ ਦੀ ਖੁਰਾਕ ਸਰਦੀਆਂ ਵਿੱਚ ਗਰਮੀਆਂ ਦੀ ਖੁਰਾਕ ਗਰਮੀਆਂ ਵਿੱਚ ਤਾਂ ਕਿ ਉੱਦਾਂ ਦਾ ਹੀ ਪੋਸ਼ਣ ਤੱਤ ਮਿਲਦਾ ਹੈ ਫਿਰ